ਪਾਣੀ ਦੀ ਲੋੜ ਸਵੇਰ ਤੋਂ ਹੀ ਸਟਾਰਟ ਹੋ ਜਾਂਦੀ ਹੈ ਸਵੇਰੇ ਬ੍ਰਸ਼ ਕਰਨ ਤੋਂ ਲੈ ਕੇ ਨਹਾਉਣ ਤੋਂ ਲੈ ਕੇ ਨਾਸ਼ਤਾ ਬਣਾਉਣ ਤੱਕ ਅਤੇ ਉਸ ਤੋਂ ਬਾਅਦ ਦਿਨ ਦੇ ਵਿੱਚ ਕਈ ਤਰ੍ਹਾਂ ਦੇ ਮੀਲ ਬਣਾਉਣ ਦੇ ਵਿੱਚ ਕੰਮ ਆਉਂਦਾ ਹੈ ਪਾਣੀ ਦੀ ਵਰਤੋਂ ਹੋਰ ਵੀ ਕਈ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਜਿਵੇਂ ਪੌਦਿਆਂ ਨੂੰ ਪਾਣੀ ਦੇਣ ਦੇ ਵਿੱਚ ਸਫਾਈ ਦੇ ਵਿੱਚ ਪੀਣ ਲਈ ਖਾਣਾ ਬਣਾਉਣ ਲਈ ਇਹਨਾਂ ਰੂਪ ਦੇ ਵਿੱਚ ਕੀਤੀ ਜਾਂਦੀ ਹੈ